ਆਧੁਨਿਕ ਯੁੱਗ ਵਿੱਚ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜੋ ਪੱਛੜਿਆ ਰਹਿ ਗਿਆ ਹੋਵੇ ਹਰ ਘਰ ਵਿੱਚ ਕੋਈ ਨਾ ਕੋਈ ਇੱਕ ਤਾਂ ਪੜ੍ਹਿਆ ਜ਼ਰੂਰ ਹੁੰਦਾ ਹੈ ਅਤੇ ਉਹ ਸਾਰੇ ਪਰਿਵਾਰ ਨੂੰ ਰਹਿਣੀ ਬਹਿਣੀ ਸਿਖਾ ਦਿੰਦਾ ਹੈ ਭਾਵ ਅੱਜ ਕੱਲ੍ਹ ਸਕੂਲਾਂ ਵਿੱਚ ਬੱਚੀਆਂ ਨੂੰ ਮਾਹਵਾਰੀ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤਰ੍ਹਾਂ ਸਾਡੇ ਸੱਭਿਆਚਾਰ ਵਿੱਚ ਮਾਹਵਾਰੀ ਦੇ ਇਲਾਜ ਪ੍ਰਤੀ ਔਰਤਾਂ ਖੁਦ ਹੀ ਬਹੁਤ ਜਾਗਰੂਕ ਹਨ ਅੱਜ ਕੱਲ੍ਹ ਦੇ ਸਮੇਂ ਹਰ ਔਰਤ ਨੂੰ ਮਾਹਵਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤਾਂ ਅਤੇ ਸਵੱਛਤਾ ਰੱਖਣ ਬਾਰੇ ਪਤਾ ਹੈ ਮਾਹਵਾਰੀ ਦੌਰਾਨ ਔਰਤਾਂ ਉੱਪਰ ਕੋਈ ਖ਼ਾਸ ਨਿਯਮ ਲਾਗੂ ਨਹੀਂ ਕੀਤੇ ਜਾਂਦੇ ਸਗੋਂ ਉਹਨਾਂ ਨੂੰ ਆਰਾਮ ਕਰਨ ਦਿੱਤਾ ਜਾਂਦਾ ਹੈ ਤਾਂ ਜੋ ਔਰਤਾਂ ਨੂੰ ਕਿਸੇ ਪਰੇਸ਼ਾਨੀ ਜਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ